ਭੰਗੜਾ ਐਰੋਬਿਕਸ ਬਹੁਤ ਹੀ ਅੱਛਾ ਤੇ ਫਾਇਦੇਮੰਦ ਹੈ ਕਿਉਂਕਿ ਜਦੋਂ ਡਾਂਸ ਦੇ ਰੂਪ ਦੇ ਵਿੱਚ ਪੰਜਾਬੀ ਸੰਗੀਤ ਨਾਲ ਇੱਕ ਅਸੀਂ ਕਸਰਤ ਕਰਦੇ ਹਾਂ ਤੇ ਸਾਡਾ ਸਾਰਾ ਸਰੀਰ ਤੰਦਰੁਸਤ ਰਹਿੰਦਾ ਹੈ ਸਰੀਰ ਦੇ ਸਾਰੇ ਅੰਗ ਜਦੋਂ ਪੂਰੇ ਕਸਰਤ ਦੇ ਰੂਪ ਵਿੱਚ ਇਸ ਨੂੰ ਅੱਛੀ ਤਰ੍ਹਾਂ ਦੇ ਨਾਲ ਰੋਗ ਮੁਕਤ ਵੀ ਕਰਦੇ ਹਨ ਇਸ ਲਈ ਭੰਗੜਾ ਐਰੋਬਿਕਸ ਬਹੁਤ ਹੀ ਜਿਆਦਾ ਫਾਇਦੇਮੰਦ ਹੈ